ਹਾਂ ਮੈਂ ਆਪਣੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦਾ ਹਾਂ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਦਾ ਹੈ ਅਤੇ ਮੈਂ ਆਪਣੀ ਵਧੀਆ ਤੋਂ ਵਧੀਆ ਅਤੇ ਸੋਹਣੇ ਤੋਂ ਸੋਹਣੇ ਕੱਪੜੇ ਪਾ ਕੇ ਉੱਥੇ ਆਪਣੀ ਪ੍ਰਤਿਮਾ ਨੂੰ ਸ਼ੋ ਕਰਦਾ ਹਾਂ ਮੈਨੂੰ ਨਵੇਂ ਨਵੇਂ ਲੋਕਾਂ ਨੂੰ ਜਾਣਨ ਅਤੇ ਆਪਣੀ ਪ੍ਰੋਫਾਈਲ ਦਿਖਾਉਣ ਦਾ ਬਹੁਤ ਹੀ ਸ਼ੌਕ ਹੈ ਅਤੇ ਅੱਛਾ ਲੱਗਦਾ ਹੈ ਅਤੇ ਮੈਂ ਆਪਣੀ ਜ਼ਿਆਦਾਤਰ ਪੋਸਟਾਂ ਨੂੰ ਇੰਸਟਾਗਰਾਮ ਉੱਤੇ ਪਾਉਂਦਾ ਹਾਂ ਉੱਥੇ ਮੇਰੇ ਬਹੁਤ ਹੀ ਫਰੈਂਡ ਨੇ ਅਤੇ ਪੋਸਟ ਪਾਉਣ ਨਾਲ ਮੇਰਾ ਕੌਨਫੀਡੈਂਸ ਅਤੇ ਮਨ ਨੂੰ ਖੁਸ਼ੀ ਮਿਲਦੀ ਹੈ